ਮੈਂ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ 'ਚ ਰਹਿੰਦੀ ਹਾਂ ਜਿੱਥੇ ਭੰਗੜਾ ਜਿਹੜਾ ਹੈਗਾ ਬਹੁਤ ਹੀ ਫੇਮਸ ਹੈ ਗਿੱਧਾ ਵੀ ਬਹੁਤ ਫੇਮਸ ਹੈ ਅਤੇ ਸਾਡੇ ਜਿਹੜਾ ਪਿੰਡ ਹੈ ਉਹਦੇ ਵਿੱਚ ਡਾਂਸ ਅਕੈਡਮੀ ਤਾਂ ਕੋਈ ਨਹੀਂ ਹੈ ਜਿਹਦੇ ਕਰਕੇ ਜਿਹੜੇ ਨੌਜਵਾਨ ਨੇ ਉਹ ਜ਼ਿਆਦਾ ਇੰਨੇ ਡਾਂਸ ਅਕੈਡਮੀ ਨਾਲ ਜੁੜੇ ਨਹੀਂ ਹੋਏ ਹਨ ਬਟ ਅੱਜ ਕੱਲ੍ਹ ਜਿਵੇਂ ਇੰਟਰਨੈਟ ਹੋ ਗਿਆ ਆਪਣੇ ਜਿਹੜੇ ਹੈਗੇ ਨੇ ਸ਼ੋਸ਼ਲ ਮੀਡੀਆ ਹੋ ਗਿਆ ਉਹਨਾਂ ਦੇ ਥਰੂ ਉਹ ਕਈ ਡਾਂਸ ਫੋਰਮਸ ਨਾਲ ਜੁੜ ਗਏ ਨੇ ਇਕੱਲਾ ਸਿਰਫ਼ ਉਹਨਾਂ ਦਾ ਜਿਹੜਾ ਡਾਂਸ ਫੋਮ ਹੈ ਜਾਂ ਫਿਰ ਜਿਹੜਾ ਉਹਨਾਂ ਦਾ ਡਾਂਸ ਸਿਰਫ਼ ਭੰਗੜੇ ਜਾਂ ਗਿੱਧੇ ਤੱਕ ਹੀ ਸੀਮਿਤ ਨਹੀਂ ਆ ਉਸ ਤੋਂ ਇਲਾਵਾ ਕਈ ਤਰ੍ਹਾਂ ਦੇ ਜਿਹੜੇ ਡਾਂਸ ਫੋਮਸ ਨੇ ਉਹਨਾਂ ਨਾਲ ਉਹ ਜੁੜੇ ਹੋਏ ਨੇ ਅਤੇ ਸ਼ੋਸ਼ਲ ਮੀਡੀਆ ਜਿਹੜਾ ਹੈਗਾ ਸਭ ਤੋਂ ਵੱਧ ਜਿਹੜਾ ਹੈਗਾ ਇਹਦੇ ਵਿੱਚ ਰੋਲ ਪਲੇਅ ਕਰਦਾ ਕਿਉਂਕਿ ਸ਼ੋਸ਼ਲ ਮੀਡੀਆ 'ਤੇ ਅਸੀਂ ਅੱਜ ਕੱਲ੍ਹ ਔਨਲਾਈਨ ਕਲਾਸਿਜ ਵੀ ਲੈ ਸਕਦੇ ਹਾਂ ਪੈਸੇ ਪੇਅ ਕਰਕੇ ਅਤੇ ਡਾਂਸ ਅਕੈਡਮੀ ਦੀ ਉੱਥੇ ਅਵੇਲੇਬਿਲਟੀ ਨਹੀਂ ਹੈ ਜਿਹਦੇ ਕਰਕੇ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਵੈਸੇ ਤਾਂ ਬਟ ਉਹ ਇੰਨੇ ਡੈਡੀਕੇਟਡ ਨੇ ਆਪਣੇ ਡਾਂਸ ਨੂੰ ਲੈ ਕੇ ਉਹ ਕਦੇ ਕਦੇ ਔਨਲਾਈਨ ਅ ਕਲਾਸਿਜ਼ ਦੇ ਥਰੂ ਆਪਣੇ ਜਿਹੜਾ ਹੈਗਾ ਡਾਂਸ ਨੂੰ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਲੈਂਦੇ ਨੇ ਅਤੇ ਨਾਲ ਜਿਹੜਾ ਹੈਗਾ ਹਰ ਰੋਜ਼ ਪ੍ਰੈਕਟਿਸ ਵੀ ਕਰਦੇ ਨੇ ਅਤੇ ਮੈਂ ਕਈ ਵਾਰ ਉਹਨਾਂ ਨੂੰ ਦੇਖਿਆ ਵੀ ਹੈ ਉੱਥੇ ਮੇਨ ਜਿਹੜੇ ਹੈਗੇ ਨੇ ਡਾਂਸ ਫੋਮਸ ਵੈਸੇ ਤਾਂ ਭੰਗੜਾ ਹੈ ਮੇਨਲੀ ਬਟ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਕਈ ਤਰ੍ਹਾਂ ਦੇ ਜਿਵੇਂ ਅੱਜ ਕੱਲ੍ਹ ਮੈਂ ਇੱਕ ਮੁੰਡੇ ਨੂੰ ਦੇਖਿਆ ਆ ਕਿ ਉਹ ਬੈਲੀ ਡਾਂਸ ਵੀ ਕਰਦਾ ਅਤੇ ਬੜਾ ਸੋਹਣਾ ਕਰਦਾ ਅਤੇ ਉਹ ਜਿਹੜਾ ਹੈਗਾ ਸ਼ੋਸ਼ਲ ਮੀਡੀਆ ਦੇ ਥਰੂ ਹੀ ਜੁਣ ਚੁਣਿਆ ਹੋਇਆ ਅਤੇ ਮੈਂ ਇੱਕ ਵਾਰੀ ਗੱਲਬਾਤ ਵੀ ਕੀਤੀ ਸੀ ਉਸ ਮੁੰਡੇ ਨਾਲ ਅਤੇ ਉਸ ਨੇ ਦੱਸਿਆ ਸੀ ਕਿ ਉਹ ਜਿਹੜਾ ਇੰਟਰਨੈਟ 'ਤੇ ਪਹਿਲਾਂ ਦੇਖ ਦੇਖ ਕੇ ਟਰਾਈ ਕਰਦਾ ਸੀ ਅਤੇ ਉਸ ਤੋਂ ਬਾਅਦ ਹੁਣ ਜਿਹੜਾ ਹੈਗਾ ਉਹਨਾਂ ਨੇ ਇੱਕ ਜਿਹੜੀ ਪ ਪਰਟੀਕੁਲਰ ਸ਼ੋਸ਼ਲ ਮੀਡੀਆ 'ਤੇ ਇੱਕ ਔਨਲਾਈਨ ਕਲਾਸਿਜ਼ ਲੈਣਾ ਉਹਨੇ ਚਾਲੂ ਕੀਤੀਆਂ ਨੇ ਅਤੇ ਹੌਲੀ ਹੌਲੀ ਜਿਹੜੀ ਹੈਗੀ ਉਹਦੀ ਇਮਪਰੂਵਮੈਂਟ ਵੀ ਹੋ ਰਹੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਡਾਂਸ ਅਕੈਡਮੀ ਤੋਂ ਬਿਨਾਂ ਸ਼ੋਸ਼ਲ ਮੀਡੀਆ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇਅ ਕਰਦਾ ਆਪਣੇ ਡਾਂਸ ਫੋਮਸ ਨੂੰ ਸਿੱਖਣ ਲਈ ਡਾਂਸ ਫੋਮਸ ਨਾਲ ਜੁੜਨ ਲਈ